ਮੈਂ ਪਿਛਲੇ ਦਿਨੀ ਇੱਕ ਪਿੰਡ ਦੀ ਚਿੱਤਰਕਾਰੀ ਬਣਾਈ ਸੀ ਜਿਸ ਦੇ ਵਿੱਚ ਮੈਂ ਪੂਰੇ ਪਿੰਡ ਦਾ ਵਰਣਨ ਕੀਤਾ ਹੋਇਆ ਹੈ ਕਿਵੇਂ ਇੱਕ ਪਾਸੇ ਚਾਰ ਪੰਜ ਬੱਚੇ ਖੇਡ ਰਹੇ ਹਨ ਉਹਨਾਂ ਦੀ ਮਾਂ ਸਾਈਡ ਤੋਂ ਖੂਹ ਤੋਂ ਪਾਣੀ ਭਰ ਕੇ ਲੈ ਕੇ ਜਾ ਰਹੀ ਹੈ ਇੱਕ ਔਰਤ ਆਪਣੇ ਪਤੀ ਲਈ ਖਾਣਾ ਬਣਾ ਰਹੀ ਹੈ ਅਤੇ ਇੱਕ ਔਰਤ ਆਪਣੇ ਪਤੀ ਨੂੰ ਖਾਣਾ ਖਿਲਾ ਰਹੀ ਹੈ ਇੱਕ ਔਰਤ ਆਪਣੇ ਬੱਚਿਆਂ ਦੇ ਪਿੱਛੇ ਭੱਜ ਰਹੀ ਹੈ ਗਾਂ ਚਾਰਾ ਚਰ ਰਹੀ ਹੈ ਕੋਈ ਦੁੱਧ ਕੱਢ ਰਿਹਾ ਹੈ ਕੋਈ ਚੂੜੀਆਂ ਵੇਚ ਰਿਹਾ ਹੈ ਇਹ ਵਾਲੀ ਪੇਂਟਿੰਗ ਮੈਂ ਬਣਾਈ ਸੀ ਅਤੇ ਮੇਰੀ ਇਹ ਪੇਂਟਿੰਗ ਸਭ ਨੂੰ ਬਹੁਤ ਵਧੀਆ ਲੱਗੀ ਪਰ ਵਧੀਆ ਦੇ ਨਾਲ ਨਾਲ ਕਿਸੇ ਨੇ ਮੈਨੂੰ ਕੁਛ ਕਮੀਆਂ ਵੀ ਇਸ ਬਾਰੇ ਦੱਸੀਆਂ ਵੀ ਜੇ ਅਗਰ ਇਹ ਇਸ ਵਿੱਚ ਇਹ ਵਾਲੀ ਕਮੀ ਨਾ ਹੁੰਦੀ ਤਾਂ ਇਹ ਹੋਰ ਵੀ ਬਹੁਤ ਜ਼ਿਆਦਾ ਵਧੀਆ ਬਣ ਜਾਂਦੀ ਅਤੇ ਫਿਰ ਮੈਂ ਉਹਨਾਂ ਦੀਆਂ ਉਸ ਕਮੀਆਂ ਨੂੰ ਧਿਆਨ ਵਿੱਚ ਰੱਖਿਆ ਅਤੇ ਕੋਸ਼ਿਸ਼ ਕੀਤੀ ਕਿ ਅੱਗੇ ਤੋਂ ਮੈਂ ਜਿਹੜੀ ਵੀ ਪੇਂਟਿੰਗ ਬਣਾਵਾਂ ਉਹਨਾਂ ਕਮੀਆਂ ਨੂੰ ਪੂਰਾ ਕਰ ਸਕਾਂ ਅਤੇ ਜਦੋਂ ਮੈਂ ਅਗਲੀ ਇੱਕ ਹੋਰ ਪੇਂਟਿੰਗ ਬਣਾਈ ਤਾਂ ਮੈਂ ਦਿਮਾਗ ਦੇ ਵਿੱਚ ਪ੍ਰਸ਼ੰਸਾ ਵਾਲੀਆਂ ਗੱਲਾਂ ਵੀ ਅਤੇ ਕਮੀਆਂ ਵਾਲੀਆਂ ਗੱਲਾਂ ਵੀ ਰੱਖ ਲਈਆਂ ਅਤੇ ਜਿੱਥੇ ਜਿੱਥੇ ਮੈਨੂੰ ਲੱਗਿਆ ਬਈ ਇਹ ਕਮੀ ਪੂਰੀ ਕੀਤੀ ਜਾ ਸਕਦੀ ਹੈ ਉੱਥੇ ਮੈਂ ਉਸ ਕਮੀ ਨੂੰ ਪੂਰਾ ਕਰਨ ਦਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਬੇਹਤਰੀਨ ਪੇਂਟਿੰਗ ਬਣਾਈ